ਅੱਜ ਦੇ ਸਮਾਜ ਵਿੱਚ ਤਕਨੋਲਜੀ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋ ਗਈ ਹੈ ਖ਼ਾਸ ਕਰਕੇ ਸਿੱਖਿਆ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਤਕਨੋਲਜੀ ਦੇ ਨਾਲ ਸਿੱਖਣ ਦੇ ਤਰੀਕੇ ਬਿਲਕੁਲ ਬਦਲ ਗਏ ਹਨ ਜਿੱਥੇ ਇੱਕ ਸਮੇਂ ਵਿਦਿਆਰਥੀਆਂ ਨੂੰ ਗੱਲਾਂ ਸਿੱਖਣ ਲਈ ਕਿਤਾਬਾਂ ਅਤੇ ਲੈਕਚਰਸ ਦਾ ਸਹਾਰਾ ਲੈਣਾ ਪੈਂਦਾ ਸੀ ਉਸ ਉ ਉੱਥੇ ਹੁਣ ਟੈਬਲੇਟ ਕੰਪਿਊਟਰ ਅਤੇ ਇੰਟਰਨੈਟ ਵਰਗੀਆਂ ਤਕਨੋਲਜੀ ਦੇ ਉਪਕਰਾਂ ਉ ਉਪਕਰਨਾਂ ਦੀ ਵਰਤੋਂ ਨਾਲ ਸਿੱਖਣ ਦੇ ਤਰੀਕੇ ਬਹੁਤ ਆਸਾਨ ਅਤੇ ਦੇਖਣ ਵਾਲੇ ਹੋ ਗਏ ਹਨ ਇੱਕ ਉਦਾਹਰਨ ਦੇ ਤੌਰ 'ਤੇ ਵਰਚੁਅਲ ਫੀਲਡ ਟ੍ਰਿਪ ਨੂੰ ਦੇਖ ਸਕਦੇ ਹਾਂ ਪਹਿਲਾਂ ਵਿਦਿਆਰਥੀਆਂ ਨੂੰ ਖਾ ਖ਼ਾਸ ਸਥਾਨ ਜਾਂ ਇਤਿਹਾਸਿਕ ਥਾਂ ਦੀ ਯਾਤਰਾ ਕਰਨ ਲਈ ਸਰੀਰਿਕ ਰੂਪ ਵਿੱਚ ਜਾ ਕੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਿੱਖਣ ਸਿੱਖਣਾ ਪੈਂਦਾ ਸੀ ਪਰ ਹੁਣ ਅਸੀਂ ਇੰਟਰਨੈਟ ਦੁਆਰਾ ਇਸ ਸਭ ਨੂੰ ਵਰਚੁਅਲ ਕਰ ਸਕਦੇ ਹਾਂ ਇਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਹਰ ਥਾਂ ਦੀ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਸਿੱਖਿਆ ਵਿੱਚ ਤਕਨੋਲਜੀ ਦੇ ਇਸ ਤਰੀਕੇ ਨਾਲ ਪਹੁੰਚ ਕਰਨ ਨਾਲ ਨਾ ਸਿਰਫ਼ ਸਿੱਖਣ ਦਾ ਤਰੀਕਾ ਬਦਲ ਬਦਲਿਆ ਹੈ ਬਲਕਿ ਸਿੱਖਿਆ ਨੂੰ ਹੋਰ ਇੰਟਰ ਇੰਟਰੈਕਟਿਵ ਅਤੇ ਮਨੋਰੰਜਨ ਵੀ ਬਣਾਉਣਾ ਬਣਾ ਬਣਾਇਆ ਗਿਆ ਹੈ ਕਲਾਸਰੂਮ ਵਿੱਚ ਵੀ ਮਲਟੀ ਡੀ ਮਲਟੀ ਮਲਟੀਡੀਆ ਮਲਟੀਡੀਆ ਅਤੇ ਸੋਫਟਵੇਅਰ ਦੇ ਰਾਹੀਂ ਸਿੱਖਿਆ ਦਿੱਤੀ ਗਈ ਹੈ ਧੰਨਵਾਦ